ਪੰਜਾਬੀ ਭਾਸ਼ਾ ਪੰਜਾਬ ਦੀ ਮੁੱਖ ਭਾਸ਼ਾ ਹੈ ਇਸ ਨੂੰ ਪੰਜਾਬੀਆਂ ਦੀ ਮਾਂ ਬੋਲੀ ਵੀ ਕਿਹਾ ਜਾਂਦਾ ਹੈ ਇਸ ਨੂੰ ਗੁਰਮੁਖੀ ਲਿਪੀ ਅਤੇ ਪੈਂਤੀ ਅੱਖਰੀ ਵੀ ਕਿਹਾ ਜਾਂਦਾ ਹੈ ਇਹ ਬਹੁਤ ਹੀ ਮਿੱਠੀ ਭਾਸ਼ਾ ਹੈ ਜਿਸ ਨੂੰ ਆਸਾਨੀ ਦੇ ਨਾਲ ਬੋਲਿਆ ਅਤੇ ਸਮਝਿਆ ਜਾ ਸਕਦਾ ਹੈ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬੋਲੀ ਅਤੇ ਸਮਝੀ ਜਾਂਦੀ ਹੈ ਮੈਨੂੰ ਪੰਜਾਬੀ ਭਾਸ਼ਾ ਬਹੁਤ ਪਸੰਦ ਹੈ ਮੈਨੂੰ ਪੰਜਾਬੀ ਵਿੱਚ ਗਾਣੇ ਸੁਣਨੇ ਫਿਲਮਾਂ ਦੇਖਣੀਆਂ ਬਹੁਤ ਪਸੰਦ ਹਨ ਅੱਜ ਕੱਲ੍ਹ ਹਿੰਦੀ ਫਿਲਮਾਂ ਵਿੱਚ ਵੀ ਹਰ ਕਰੈਕਟਰ ਹਰ ਇ ਕੋਈ ਨਾ ਕੋਈ ਇੱਕ ਕਰੈਕਟਰ ਪੰਜਾਬੀ ਜ਼ਰੂਰ ਹੁੰਦਾ ਹੈ ਔਰ ਉਹ ਬਹੁਤ ਹੀ ਹਿੱਟ ਹੁੰਦਾ ਹੈ ਮੈਨੂੰ ਪੰਜਾਬੀ ਭਾਸ਼ਾ ਬਹੁਤ ਵਧੀਆ ਲੱਗਦੀ ਹੈ ਇਸ ਲਈ ਮੈਂ ਹਮੇਸ਼ਾ ਪੰਜਾਬੀ ਹੀ ਬੋਲਦੀ ਹਾਂ ਔਰ ਮੈਂ ਬੱਚਿਆਂ ਨੂੰ ਵੀ ਪੰਜਾਬੀ ਬੋਲਣ ਲਈ ਕਹਿੰਦੀ ਹਾਂ ਪੰਜਾਬੀ ਬੋਲ ਕੇ ਸਾਨੂੰ ਇੱਕ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ